ਭਾਰਤ ਵਿੱਚ ਵੈਸੇ ਸੱਭਿਆਚਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਪੁਰਾਣੇ ਸੱਭਿਆਚਾਰਕ ਗੀਤ ਵਗੈਰਾ ਬਹੁਤ ਸਾਰੀਆਂ ਪਰੰਪਰਾਵਾਂ ਸ਼ੁਰੂ ਤੋਂ ਹੀ ਚੱਲਦੀਆਂ ਆ ਰਹੀਆਂ ਏ ਜਿਵੇਂ ਕਿ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਕਿ ਇੱਥੇ ਜਿਹੜੇ ਆ ਪਰੰਪਰਾ ਇਹ ਚੱਲਦੀ ਆ ਰਹੀ ਹੈ ਪੁਰਾਣੇ ਸਮੇਂ ਤੋਂ ਕਿ ਇਹਨਾਂ ਦੇ ਇੱਥੇ ਜਿਹੜੇ ਕੋਈ ਵੀ ਫੰਕਸ਼ਨ ਜਾਂ ਫਿਰ ਕੋਈ ਵੀ ਤਿਉਹਾਰ ਹੈ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਸਾਰੇ ਲੋਕ ਬਹੁਤ ਹੀ ਧੂਮ ਧਾਮ ਨਾਲ ਇੱਕ ਦੂਜੇ ਨਾਲ ਮਿਲਜੁਲ ਕੇ ਸਾਰੇ ਜਿਹੜੇ ਤਿਉਹਾਰ ਆ ਮਨਾਉਂਦੇ ਆ ਜਿਹਦੇ ਨਾਲ ਉਹ ਇੱਕ ਸਮੇਂ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਨੂੰ ਇੱਕ ਦੂਜੇ ਨਾਲ ਸੈਲੀਬ੍ਰੇਟ ਕਰਦੇ ਆ ਅਤੇ ਸਾਰੇ ਜਾਣੇ ਵਧੀਆ ਵਧੀਆ ਕੱਪੜੇ ਇੱਕ ਦੂਜੇ ਨੂੰ ਗਿਫ਼ਟ ਦੇ ਕੇ ਮਿਠਾਈਆਂ ਦੇ ਕੇ ਆਪਣੀ ਖੁਸ਼ੀ ਇੱਕ ਦੂਜੇ ਨਾਲ ਵਧਾਉਂਦੇ ਆ ਅਤੇ ਇਹਨਾਂ ਸਾਰਿਆਂ ਨੂੰ ਵਧੀਆ ਤਰ੍ਹਾਂ ਸੈਲੀਬ੍ਰੇਟ ਕਰਦੇ ਹੈ